ਚਲਾਉਂਦੀ ਹਾਂ ਮੈਂ ਫੇਸਬੁੱਕ ਦੇ ਵਿੱਚ ਇੰਸਟਾਗ੍ਰਾਮ ਫੇਸਬੁੱਕ ਸ਼ੋਸ਼ਲ ਮੀਡੀਆ ਪਲੱਸ ਵਟਸਅਪ ਵੀ ਬਹੁਤ ਚਲਾਉਂਦੀ ਹਾਂ ਅਤੇ ਉਹਦੇ ਵਿੱਚ ਮੈਨੂੰ ਫੇਸਬੁੱਕ ਜ਼ਿਆਦਾ ਪਸੰਦ ਹੈ ਕਿਉਂਕਿ ਉਹਦੇ ਵਿੱਚ ਰੀਲਜ਼ ਦੇਖਣ ਨੂੰ ਮਿਲਦੀਆਂ ਕਮੇਡੀ ਕਮੇਡੀਆਂ ਦੇਖਣ ਨੂੰ ਮਿਲਦੀਆਂ ਡਰਾਮੇ ਦੇਖਣ ਨੂੰ ਮਿਲਦੇ ਹੈ

ਔਨਲਾਈਨ ਸ਼ੋਪਿੰਗ ਵੀ ਹੋ ਜਾਂਦੀ ਹੈ ਉਹਦੇ 'ਚ ਨਿਊਜ਼ ਸੁਣਨ ਨੂੰ ਮਿਲਦੇ ਹੈ ਇੰਸਟਾਗ੍ਰਾਮ ਰੀਲਜ਼ ਕਰੋਸ ਸਕਰੋਲ ਹੁੰਦੀਆਂ ਨੇ ਕਿਤੇ ਘੁੰਮਣ ਗਈ ਹਾਂ ਉੱਥੇ ਵੀਡੀਓ ਬਣਾ ਲਈਦੀ ਹੈ ਪੋਸਟ ਕਰਦੀ ਦੀ ਹੈ ਧੰਨਵਾਦ